ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਪੱਚੀ ਸਤੰਬਰ ਦੋ ਹਜ਼ਾਰ ਇੱਕ ਅਤੇ ਨੌਂ ਨਵੰਬਰ ਦੋ ਹਜ਼ਾਰ ਚਾਰ ਛੱਬੀ ਅਗਸਤ ਅਠਾਰਾਂ ਸੌ ਛਪੰਜਾ ਅਤੇ ਸਤਾਰਾਂ ਅਗਸਤ ਉੱਨੀ ਸੌ ਤੀਹ